ਅਸੀਂ ਪੰਛੀਆਂ ਦੀ ਪਛਾਣ ਉਹਨਾਂ ਦੇ ਰੰਗ ਆਕਾਰ ਆਵਾਜ਼ ਤੋਂ ਕਰ ਸਕਦੇ ਹਾਂ ਜਿਵੇਂ ਕਿ ਤੋਤੇ ਦਾ ਰੰਗ ਹਰਾ ਹੁੰਦਾ ਹੈ ਅਤੇ ਉਸ ਦੀ ਆਵਾਜ਼ ਵੀ ਅਲੱਗ ਹੁੰਦੀ ਹੈ ਕਾਂ ਅਤੇ ਕੋਇਲ ਦਾ ਰੰਗ ਕਾਲਾ ਹੁੰਦਾ ਹੈ ਉਸ ਦੂਰੋਂ ਹੀ ਪਤਾ ਲੱਗ ਜਾਂਦਾ ਹੈ ਵੀ ਕਾਂ ਅਤੇ ਕੋਇਲ ਹੈ ਕਬੂਤਰ ਦਾ ਰੰਗ ਗਰੇ ਹੁੰਦਾ ਹੈ ਆਮ ਘਰਾਂ 'ਚ ਰੱਖਣ ਵਾਲੇ ਕਬੂਤਰ ਚੀਨੇ ਹੁੰਦੇ ਹਨ ਚਿੱਟੇ ਰੰਗ ਦੇ ਹੁੰਦੇ ਹਨ ਬਹੁਤ ਸੋਹਣੇ ਫੁੱਲਾਂ ਵਾਲੇ ਹੁੰਦੇ ਹਨ ਉਹਨਾਂ ਦੇ ਖੰਭ ਇੱਕ ਫੁੱਲ ਦੀ ਤਰ੍ਹਾਂ ਬਣੇ ਹੁੰਦੇ ਹਨ ਬਣੇ ਹੁੰਦੇ ਹਨ ਉਹਨਾਂ ਦੀ ਉਡਾਨ ਕ ਉਹਨਾਂ ਦੀ ਉਡਾਨ ਘਰਾਂ 'ਚ ਰੱਖਣ ਵਾਲੇ ਕਬੂਤਰਾਂ ਦੀ ਉਡਾਨ ਛੋਟੀ ਹੁੰਦੀ ਹੈ ਜਿਹੜੇ ਕੁਦਰਤੀ ਉੱਡਣ ਵਾਲੇ ਕਬੂਤਰ ਆ ਉਹਨਾਂ ਦੀ ਉਡਾਨ ਲੰਬੀ ਹੁੰਦੀ ਹੈ ਜਿਵੇਂ ਕਿ ਇਲਾਂ ਇੱਲਾਂ ਇੱਲਾਂ ਦੀ ਉਡਾਨ ਬਹੁਤ ਲੰਬੀ ਹੁੰਦੀ ਹੈ ਕੂੰਜਾਂ ਬਹੁਤ ਇੱਕ ਲਹਿਰ ਦੇ ਵਿੱਚ ਜਾਣ ਜਾ ਰਹੀਆਂ ਹੁੰਦੀਆਂ ਹਨ ਕੋਈ ਪੰਜ ਸੱਤ ਕੂੰਜਾਂ ਦੀ ਇਕੱਠੀ ਉਡਾਨ ਹੁੰਦੀ ਹੈ ਫਿਰ ਉਨ੍ਹਾਂ ਦੀ ਜੇ ਸਾਨੂੰ ਫਿਰ ਵੀ ਨਹੀਂ ਪਤਾ ਲੱਗਦਾ ਵੀ ਇਹ ਕਿਹੜਾ ਪੰਛੀ ਹੈ ਅਤੇ ਫਿਰ ਅਸੀਂ ਇੱਕ ਐਪ ਦੀ ਵਰਤੋ ਕਰਦੇ ਹਾਂ